ਹਾਂਜੀ ਸਰਕਾਰ ਦੀਆਂ ਬਹੁਤ ਹੈਲਪਲਾਈਨ ਹੈਗੀਆਂ ਨੇ ਪਰ ਸਾਨੂੰ ਫ਼ਾਇਦਾ ਇਹਨਾਂ ਦਾ ਕੋਈ ਹਜੇ ਹੈਗਾ ਨਹੀਂ ਹੈ ਕਿਉਂਕਿ ਜਿਸ ਤਰ੍ਹਾਂ ਹੁਣ ਕਿਸਾਨ ਕਰਜ਼ਾ ਚੁੱਕ ਲੈਂਦੇ ਆ ਵੀ ਅਸੀਂ ਕਰਜ਼ਾ ਲੈ ਲਈਏ ਅਸੀਂ ਕੋਈ ਮਜ਼ਬੂਰੀ ਵਾਸਤੇ ਉਹ ਕਰਜ਼ਾ ਲੈ ਲੈਂਦੇ ਕੁਛ ਕੰਮ ਕਰਨ ਵਾਸਤੇ ਜਾਂ ਕਿੱਦਾਂ ਫ਼ਸਲਾਂ ਬੀਜਦੇ ਆ ਉਹਨਾਂ ਨੂੰ ਖਾਦਾਂ ਦਵਾਈਆਂ ਪਾਉਣ ਵਾਸਤੇ ਵੀ ਕਰਜ਼ਾ ਚੁੱਕ ਲੈਂਦੇ ਆ ਵੀ ਕੋਈ ਗੱਲ ਨਹੀਂ ਜਿਸ ਤਰ੍ਹਾਂ ਉਹਨਾਂ ਘਰ ਵਿੱਚ ਕੋਈ ਆਪਣੇ ਮੱਝਾਂ ਵਗੈਰਾ ਪਾ ਕੇ ਆਪਣਾ ਦੁੱਧ ਦਾ ਕੰਮ ਡੇਅਰੀ ਦਾ ਚਲਾਉਣਾ ਹੋਵੇ ਤਾਂ ਵੀ ਕਰਜ਼ਾ ਚੁੱਕ ਲੈਂਦੇ ਆ ਵੀ ਕੋਈ ਗੱਲ ਨਹੀਂ ਅਸੀਂ ਫ਼ਸਲ ਬੀਜੀ ਹੋਈ ਆ ਅਤੇ ਇਹ ਫ਼ਸਲ ਨੂੰ ਜਦੋਂ ਪੱਕੂਗੀ ਇਹਨੂੰ ਵੱਢਾਂਗੇ ਫਿਰ ਜੇ ਇਹਨੂੰ ਵੇਚ ਕੇ ਅਸੀਂ ਪੈਸੇ ਕਮਾਵਾਂਗੇ ਅਤੇ ਆਪਣਾ ਕਰਜ਼ਾ ਜਿਹੜਾ ਉਹ ਲਾਹਦਾਂਗੇ ਪਰ ਇੱਦਾਂ ਹੁੰਦਾ ਨਹੀਂ ਆ ਕਿ ਜਿਸ ਤਰ੍ਹਾਂ ਕਈ ਵਾਰ ਹੜ੍ਹ ਆ ਜਾਂਦੇ ਆ ਕਦੇ ਗੜ੍ਹੇਮਾਰੀ ਹੋ ਗਈ ਤੂਫ਼ਾਨ ਆ ਗਏ ਮੀਂਹ ਪੈ ਗਏ ਇਸ ਤਰ੍ਹਾਂ ਜਿਹੜੇ ਕਿਸਾਨ ਦੀ ਬੀਜੀ ਹੋਈ ਫ਼ਸਲ ਜਿਹੜੀ ਆ ਉਹ ਬਰਬਾਦ ਹੋ ਜਾਂਦੀ ਆ ਅਤੇ ਇਸ ਤਰ੍ਹਾਂ ਕਿਸਾਨ ਵਿਚਾਰਾ ਜਿਹੜਾ ਵਾ ਉਹ ਆਪਣਾ ਕਰਜ਼ਾ ਨਾ ਨਹੀਂ ਲਾਹ ਪਾਉਂਦਾ ਅਤੇ ਕਿਸਾਨ ਨੂੰ ਖੁਦਕੁਸ਼ੀ ਕਰਨ ਲਈ ਮਜ਼ਬੂਰ ਹੋ ਜਾਂਦਾ ਹੈ ਅਤੇ ਉਹਨੂੰ ਖੁਦਕੁਸ਼ੀ ਕਰਨੀ ਪੈਂਦੀ ਹੈ ਜਿਸ ਤਰ੍ਹਾਂ ਹੁਣ ਜਿੱਦਾਂ ਸਾਡੇ ਲਾਗੇ ਸਲਾਹ ਕੇਂਦਰ ਜਿਹੜਾ ਵਾ ਉਹ ਬਣਿਆ ਹੋਇਆ ਹੈ ਤਾਂ ਉੱਥੇ ਜਾ ਕੇ ਸਲਾਹ ਮਸ਼ਵਰਾ ਕੀਤਾ ਜਾਂਦਾ ਹੈ ਕਿਸਾਨਾਂ ਦੀਆਂ ਸਲਾਹ ਲਈ ਜਾਂਦੀ ਆ ਉਹਨਾਂ ਨੂੰ ਦੱਸਿਆ ਵੀ ਜਾਂਦਾ ਵਾ ਜੋ ਵੀ ਸਲਾਹ ਮਸ਼ਵਰਾ ਹੋਵੇ ਉਹਨਾਂ ਦੀ ਆਪਸ ਵਿੱਚ ਕੀਤੀ ਜਾਂਦੀ ਹੈ ਪਰ ਇਹ ਕਿਸਾਨ ਦਾ ਪਰਿਵਾਰ ਜਿਹੜਾ ਉਹਨਾਂ ਲਈ ਬਹੁਤ ਔਖਾ ਹੋ ਜਾਂਦਾ ਵਾ ਕਿ ਜਦੋਂ ਉਹਨਾਂ ਦਾ ਜਿਹੜਾ ਕਿਸਾਨ ਪਰਿਵਾਰ ਦਾ ਮੈਂਬਰ ਹੁੰਦਾ ਮੇਨ ਜਿਹਦੇ ਸਿਰ 'ਤੇ ਸਾਰਾ ਪਰਿਵਾਰ ਚੱਲਦਾ ਹੋਵੇ ਉਹ ਹੀ ਖੁਦਕੁਸ਼ੀ ਕਰ ਲਵੇ ਤਾਂ ਕਿਸਾਨ ਦੇ ਪਰਿਵਾਰ ਲਈ ਬਹੁਤ ਔਖਾ ਹੋ ਜਾਂਦਾ ਇਹ ਕੰਮ ਕਿਸਾਨ ਵੀ ਖੁਦਕੁਸ਼ੀ ਕਰਨ ਲਈ ਮਜ਼ਬੂਰ ਹੋ ਜਾਂਦਾ ਵਾ ਜਦੋਂ ਉਹਦਾ ਕਰਜ਼ਾ ਲੱਥਦਾ ਨਹੀਂ ਵਿਚਾਰੇ ਦਾ ਫਿਰ ਉਹਨੂੰ ਖੁਦਕੁਸ਼ੀ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਹੀ ਨਹੀਂ ਰਹਿ ਜਾਂਦਾ ਉਹਦੇ ਲਈ ਵੀ ਹੁਣ ਮੈਂ ਕਰੂੰ ਤਾਂ ਕੀ ਕਰੂੰ ਵੀ ਜਦੋਂ ਫ਼ਸਲ ਜਿਹੜੀ ਖੜ੍ਹੀ ਸੀ ਉਹਦੇ ਵੱਲ ਵੇਖਦਾ ਸੀਗਾ ਵੀ ਉਹ ਆਉਗੀ ਛੇ ਮਹੀਨਿਆਂ ਬਾਅਦ ਫ਼ਸਲ ਆਉਣੀ ਸੀ ਸਾਰਾ ਕਰਜ਼ਾ ਵੀ ਲਾਹ ਦੇਣਾ ਸੁੱਖ ਦੀ ਰੋਟੀ ਖਾਵਾਂਗੇ ਸੁੱਖ ਦਾ ਆਪਣਾ ਸਮਾਂ ਬਤੀਤ ਕਰਾਂਗੇ ਪਰ ਉਹ ਕਰ ਨਹੀਂ ਪਾਉਂਦੇ ਵਿਚਾਰੇ ਹੁਣ ਇਸ ਕਰਕੇ ਜਿੱਦਾਂ ਹੁਣ ਜਿਹੜੀ ਤਨਖ਼ਾਹ ਜਿਹੜੀ ਨੌਕਰੀਆਂ ਵਾਲੇ ਨੇ ਉਹਨਾਂ ਨੂੰ ਤਾਂ ਮਹੀਨੇ ਪਿੱਛੋਂ ਤਨਖ਼ਾਹ ਆ ਜਾਣੀ ਆ ਜਾਂ ਕਿੱਦਾਂ ਵੀ ਆ ਸਰਕਾਰੀ ਹੋਣ ਪ੍ਰਾਈਵੇਟ ਉਹਨਾਂ ਨੂੰ ਕੋਈ ਨਾ ਕੋਈ ਮਿਲਦਾ ਹੀ ਰਹਿੰਦਾ ਵਾ ਮਹੀਨੇ ਪਿੱਛੋਂ ਆਪਣੀ ਤਨਖ਼ਾਹ ਆਉਣੀ ਆਪਣਾ ਕੰਮ ਚਲਾਉਣਾ ਪਰ ਜਿਹੜਾ ਕਿਸਾਨ ਆ ਇਹਨਾਂ ਵਿਚਾਰਿਆਂ ਨੇ ਇਹਦੇ ਪਰਿਵਾਰ ਨੇ ਛੇ ਮਹੀਨੇ ਤੱਕ ਵੇਖਣਾ ਹੁੰਦਾ ਵਾ ਕਿ ਅਸੀਂ ਜਿਹੜੀ ਫ਼ਸਲ ਬੀਜੀ ਆ ਉਹਨੂੰ ਕੱਟਾਂਗੇ ਵੱਢਾਂਗੇ ਉਹਨੂੰ ਵੇਚਾਂਗੇ ਪੱਕੂਗੀ ਅਤੇ ਪੈਸੇ ਆਉਣਗੇ ਨਾਲੇ ਅਸੀਂ ਆਪਣਾ ਕਰਜ਼ਾ ਲਾਹਵਾਂਗੇ ਨਾਲੇ ਅਸੀਂ ਆਪਣੇ ਘਰ ਵਿੱਚ ਸੁੱਖ ਦੀ ਰੋਟੀ ਖਾਵਾਂਗੇ ਪਰ ਉਹ ਉਹਨਾਂ ਨੂੰ ਨਸੀਬ ਨਹੀਂ ਹੁੰਦਾ ਜਦੋਂ ਕੁਦਰਤ ਦੀ ਮਾਰ ਵੱਜ ਜਾਂਦੀ ਆ ਗੜ੍ਹੇ ਹਨੇਰੀਆਂ ਮੀਂਹ ਆ ਜਾਂਦੇ ਆ ਉਹਨਾਂ ਦੀ ਫ਼ਸਲ ਬਰਬਾਦ ਹੋ ਜਾਂਦੀ ਵਿਚਾਰਿਆਂ ਦੀ ਇਸ ਕਰਕੇ ਕਿਸਾਨ ਜਿਹੜਾ ਮਜ਼ਬੂਰ ਹੋ ਜਾਂਦਾ ਖੁਦਕੁਸ਼ੀ ਲਈ